ਮੈਂ ਜ਼ਿਆਦਾ ਤਾਂ ਕਿਤੇ ਘੁੰਮਿਆ ਨਹੀਂ ਲੇਕਿਨ ਜੇ ਮੈਂ ਪਠਾਨਕੋਟ ਦੀ ਗੱਲ ਕਰਾਂ ਤਾਂ ਪਠਾਨਕੋਟ ਵਿੱਚ ਕਾਫ਼ੀ ਫੋਰ ਫਾਰਮੇਸੀਜ ਹੈ ਮੈਡੀਕਲ ਸਟੋਰ ਹੈ ਤੁਹਾਨੂੰ ਹਰ ਜਗ੍ਹਾ 'ਤੇ ਮਤਲਬ ਇੱਕ ਛੋਟੀ ਜਿਹੇ ਬ੍ਰੇਕ ਦੇ ਬਾਅਦ ਤੁਹਾਨੂੰ ਇੱਕ ਨਾ ਇੱਕ ਮੈਡੀਕਲ ਸਟੋਰ ਮਿਲ ਹੀ ਜਾਵੇਗਾ ਅਤੇ ਜੇਕਰ ਗੱਲ ਕੀਤੀ ਜਾਵੇ ਕਿ ਕਿਵੇਂ ਦਾ ਮਤਲਬ ਇੱਥੇ ਦਾ ਉਹ ਆ ਅਤੇ ਜਿੱਦਾਂ ਇੱਥੇ ਹਿੰਟ ਦਿੱਤੇ ਗਏ ਅਰੋਗਿਆ ਹੋਸਪੀਟਲ ਹੋ ਗਿਆ ਰੰਧਾਵਾ ਹੋਸਪੀਟਲ ਹੋ ਗਿਆ ਇਹ ਕਾਫ਼ੀ ਵਧੀਆ ਕੰਮ ਕਰ ਰਹੇ ਆ ਅਤੇ ਇਹ ਮਤਲਬ ਟਾਈਮ ਟਾਈਮ 'ਤੇ ਆ ਕੇ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਆ ਜਾਂ ਫਰੀ ਦਾ ਇਲਾਜ ਕਰਦੇ ਆ ਲੋਕਾਂ ਦਾ ਜੋ ਗਰੀਬ ਲੋਕ ਹੁੰਦੇ ਆ ਅਤੇ ਇਹ ਕਾਫ਼ੀ ਵਧੀਆ ਚੀਜ਼ ਹੈ ਕਿਉਂਕਿ ਇਹ ਚੀਜ਼ ਕਾਫ਼ੀ ਹੈਲਪ ਕਰਦੀ ਆ ਲੋਕਾਂ ਦੀ ਅਤੇ ਜੋ ਕਿ ਫਾਈਨੈਂਸ਼ੀਅਲੀ ਆਪਣਾ ਇਲਾਜ ਨਹੀਂ ਕਰਵਾ ਸਕਦੇ ਅਤੇ ਫਾਈਨੈਂਸ਼ੀਅਲੀ ਵੀਕ ਹੁੰਦੇ ਆ ਉਹ ਚੀਜ਼ ਇਹ ਚੀਜ਼ ਦਾ ਲਾਭ ਉਠਾਉਂਦੇ ਆ ਅਤੇ ਬਾਕੀ ਗੱਲ ਕੀਤੀ ਜਾਵੇ ਤਾਂ ਮੈਡੀਕਲ ਹੋਸਪੀਟਲ ਤਾਂ ਕਾਫ਼ੀ ਹੈ ਇੱਕ ਸਿਵਲ ਹੋਸਪਿਟਲ ਵੀ ਹੈ ਪਠਾਨਕੋਟ ਵਿੱਚ ਜੋ ਕਿ ਫਰੀ ਇਲਾਜ ਕਰਦਾ ਅਤੇ ਇਹ ਕਾਫ਼ੀ ਵਧੀਆ ਚੀਜ਼ ਹੈ ਸਰਕਾਰ ਵੱਲੋਂ ਵੀ ਕਿ ਉਹ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੀ ਹੈ ਆਪਣੇ ਇੱਥੇ ਪਠਾਨਕੋਟ ਵਿੱਚ ਅਤੇ ਲੋਕਾਂ ਦਾ ਵੀ ਕਾਫ਼ੀ ਵਧੀਆ ਮਤਲਬ ਉਹ ਆ ਕਿ ਉਹ ਮੈਡੀਕਲ ਫੀਲਡ 'ਤੇ ਜ਼ਿਆਦਾ ਕੰਮ ਕਰ ਰਹੇ ਇੱਥੇ